ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਮਿਲ ਜਾਂਦੇ ਸਾਡੇ ਕੋਲ ਟ੍ਰਡੀਸ਼ਨਲ ਸਾਨੂੰ ਲੇਡੀਜ਼ ਕ ਸਾਡੇ ਕੋਲ ਸੂਟ ਸਲਵਾਰ ਮਿਲ ਜਾਂਦੇ ਹੈ ਜੈਨਟਸ ਲਈ ਕੁੜਤਾ ਪਜਾਮਾ ਤੁਰਲੇ ਵਾਲੀਆਂ ਪੱਗਾਂ ਸਾਰਾ ਕੁਛ ਮਿਲ ਜਾਂਦਾ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਕੁਛ ਮਿਲ ਜੂੰਗਾ ਪੱਗ ਵੀ ਮਿਲ ਜਾਏਗੀ ਹਾਂਜੀ ਹਾਂਜੀ ਲੇਡੀਜ਼ ਸੂਟ ਬੱਚਿਆਂ ਦੇ ਕੱਪੜੇ ਵੀ ਮਿਲ ਜਾਏ ਹਾਂਜੀ ਹਾਂਜੀ ਪੰਜਾਬ ਪੰਜਾਬੀ ਜੁੱਤੀ ਮਿਲ ਜਾਏਗੀ ਸਾਡਾ ਕੱਪੜਾ ਅੰਬਰਸਰ ਤੋਂ ਆਉਂਦਾ ਜੀ ਸਾਡੇ ਆਪਣੇ ਹੀ ਉਹ ਹੈ ਨੇ ਡੀਲਰ ਨੇ ਕੱਪੜਾ ਬਹੁਤ ਵਧੀਆ ਤੁਹਾਨੂੰ ਦਵਾਂਗੇ ਕੋਆਲਟੀ ਵਾਲਾ ਨਹੀਂ ਜੀ ਨਹੀਂ ਕੰਪਲੇਟ ਕਦੀ ਵੀ ਨਹੀਂ ਅਸੀਂ ਪਤਾ ਨਹੀਂ ਕਿੰਨਾ ਕੱਪੜਾ ਵੇਚ ਦਈਦਾ ਰੋਜ਼ ਅੱਜ ਤੱਕ ਨਹੀਂ ਕੋਈ ਕੰਪਲੇਟ ਆਈ ਹੈ ਸਾਡੀ ਨਵਾਂਸ਼ਹਿਰ 'ਚ ਹੈ ਜੀ ਮੇਨ ਚੌਂਕ ਦੇ ਕੋਲ ਆ ਕੇ ਕਿਸੇ ਨੂੰ ਵੀ ਪੁੱਛ ਲਿਓ ਤੁਸੀਂ ਹਾਂ ਰਾਧੇ ਸ਼ਾਮ ਹਾਂ ਮੈਂ ਲੌਕੇਸ਼ਨ ਤੁਹਾਨੂੰ ਵੱਅਟਅੱਪ ਕਰ ਦਿੰਦਾ ਹੈ ਐਡਰੱਸ ਵੀ ਤੁਹਾਨੂੰ ਮੈਂ ਵੱਟਸਅੱਪ ਕਰ ਦੂੰਗਾ ਪੂਰਾ ਹਾਂਜੀ ਹਾਂਜੀ ਮੈਂ ਇਸ ਨੰਬਰ 'ਤੇ ਭੇਜ ਦੂੰਗਾ ਤੁਹਾਨੂੰ ਹਾਂਜੀ ਕੋਈ ਨਹੀਂ ਜਦ ਆਉਂਗੇ ਮੈਨੂੰ ਕਾਲ ਕਰ ਲਿਓ ਜੇ ਤੁਹਾਨੂੰ ਕੁਛ ਪਤਾ ਨਹੀਂ ਲੱਗਿਆ ਫਿਰ ਮੈਂ ਸਮਝਾ ਦੂੰਗਾ ਹਾਂਜੀ ਹਾਂਜੀ ਹਾਂਜੀ ਕੁੜਤੇ ਕੁੜਤੇ ਪਜਾਮੇ ਲੇਡੀਜ਼ ਸ਼ਰਟ ਪੰਜਾਬੀ ਜੁੱਤੀ ਅਤੇ ਬਾਕੀ ਰੇਟ ਵੀ ਸਾਡਾ ਜੈਨੁਅਨ ਹੈ ਪੰਜ ਸੌ ਰੁਪਏ ਮੀਟਰ ਤੋਂ ਸਟਾਰਟ ਹੋ ਜਾਂਦਾ ਆ ਠੀਕ ਹੈ ਜੀ ਠੀਕ ਹੈ ਜੀ ਕੋਈ ਨਹੀਂ ਜਦ ਆਉਣਾ ਹੋਇਆ ਮੈਨੂੰ ਦੱਸ ਦਿਓ ਓਕੇ ਜੀ ਬਾਏ